ਸਾਡੇ ਭਾਈਚਾਰੇ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਸਮਾਗਮ ਹੈ ਉਹ ਵਿਆਹ ਸ਼ਾਦੀਆਂ ਦਾ ਹੁੰਦਾ ਹੈ ਉਸ ਤੋਂ ਵੀ ਜ਼ਿਆਦਾ ਮਸਤੀ ਅਤੇ ਪਾਰਟੀ ਜਿਹੜੇ ਲੋਕ ਕਰਦੇ ਨੇ ਉਹ ਉਸ ਤੋਂ ਵਿਆਹ ਤੋਂ ਇੱਕ ਦਿਨ ਪਹਿਲਾਂ ਹਰੇਕ ਘਰ ਦੇ ਵਿੱਚ ਗੀਤ ਸੰਗੀਤ ਦਾ ਪ੍ਰੋਗਰਾਮ ਹੁੰਦਾ ਹੈ ਜਿੱਥੇ ਕਿ ਸਾਰੇ ਹੀ ਰਿਸ਼ਤੇਦਾਰਾਂ ਨੂੰ ਬੁਲਾਇਆ ਜਾਂਦਾ ਹੈ ਉਸ ਪ੍ਰੋਗਰਾਮ ਦੇ ਵਿੱਚ ਸਾਰੇ ਜਾਣੇ ਇਕੱਠੇ ਹੋ ਕੇ ਗਿੱਧਾ ਪਾਉਂਦੇ ਹਨ ਭੰਗੜਾ ਪਾਉਂਦੇ ਹਨ ਪਾਰਟੀ ਕਰਦੇ ਹਨ ਖਾਣ ਪੀਣ ਦਾ ਬਹੁਤ ਹੀ ਜ਼ਿਆਦਾ ਸਮਾਨ ਜਿਹੜਾ ਹੈ ਉਹ ਉੱਥੇ ਹੁੰਦਾ ਹੈ ਜਿ ਜਿਸ ਨੂੰ ਕਿ ਬੱਚੇ ਵੀ ਬਹੁਤ ਸ਼ੌਂਕ ਦੇ ਨਾਲ ਖਾਂਦੇ ਹਨ ਇਸ ਸਮਾਗਮ ਦੇ ਵਿੱਚ ਇਹ ਸਮਾਗਮ ਰਾਤ ਦੇ ਵੇਲੇ ਕੀਤਾ ਜਾਂਦਾ ਹੈ ਜਿਸ ਦੇ ਵਿੱਚ ਕਿ ਸਾਰੇ ਜਾਣੇ ਇਕੱਠੇ ਹੋ ਕੇ ਪਹਿਲਾਂ ਤਾਂ ਜਾਗੋ ਕੱਢਦੇ ਹਨ ਜਾਗੋ ਕੱਢਣ ਤੋਂ ਬਾਅਦ ਸਾਰੇ ਜਾਣੇ ਆਪਣੇ ਜਿਹੜੇ ਪੰਜਾਬੀ ਦੇ ਸਾਡੇ ਆਪਣਾ ਪਹਿਰਾਵਾ ਹੈ ਸੂਟ ਪਾਉਂਦੇ ਹਨ ਸੂਟ ਲਹਿੰਗੇ ਇਹ ਚੀਜ਼ਾਂ ਪਾਈਆਂ ਜਾਂਦੀਆਂ ਹਨ ਨਾਲ ਹੀ ਜਿਹੜੇ ਇਸ ਵਿੱਚ ਆਦਮੀ ਲੋਕ ਹਨ ਉਹ ਕੁੜਤਾ ਪਜਾਮਾ ਉਸ 'ਤੇ ਪੱ ਅਤੇ ਜਿਹੜਾ ਪੱਗ ਹੈ ਉਸ ਪਹਿਰਾਵੇ ਨੂੰ ਪਾਇਆ ਜਾਂਦਾ ਹੈ ਉਸ ਪਹਿਰਾਵੇ ਨੂੰ ਪਾਉਣ ਤੋਂ ਬਾਅਦ ਸਾਰੇ ਜਾਣੇ ਇਕੱਠੇ ਹੋ ਕੇ ਗੀਤ ਗਾਉਂਦੇ ਹਨ ਘੋੜੀਆਂ ਗਾਉਂਦੇ ਹਨ ਵਿਆਹ ਵਾਲੇ ਮੁੰਡੇ ਅਤੇ ਵਿਆਹ ਵਾਲੀ ਕੁੜੀ ਦੋਵਾਂ ਨੂੰ ਇਕੱਠਿਆਂ ਵੀ ਕਈ ਵਾਰੀ ਲੋਕ ਕਰ ਲੈਂਦੇ ਹਨ ਅਤੇ ਉੱਥੇ ਸਾਰੇ ਜਾਣੇ ਮਿਲ ਕੇ ਬਹੁਤ ਜ਼ਿਆਦਾ ਮਸਤੀ ਕਰਦੇ ਹਨ ਇਹ ਜਿਹੜਾ ਸਮਾਗਮ ਹੈ ਇਹ ਰਾਤ ਦੇ ਵੇਲੇ ਬਹੁਤ ਬਹੁਤ ਵਾਰੀ ਜ਼ਿਆਦਾ ਟਾਈਮ ਵਾਸਤੇ ਕੀਤਾ ਜਾਂਦਾ ਹੈ ਜਿਸ ਦੇ ਵਿੱਚ ਅੱਧੀ ਰਾਤ ਤੱਕ ਇਸ ਦੇ ਵਿੱਚ ਸਾਰੇ ਲੋਕ ਮਿਲ ਕੇ ਭੰਗੜੇ ਪਾਉਂਦੇ ਹਨ ਗਿੱਧੇ ਪਾਉਂਦੇ ਹਨ ਅਤੇ ਲੋਕਾਂ ਦੇ ਘਰਾਂ ਵਿੱਚ ਵੀ ਜਾਂਦੇ ਹਨ ਆਪਣੇ ਸਾਕ ਸਬੰਧੀਆਂ ਦੇ ਘਰਾਂ ਵਿੱਚ ਜਿਹੜੇ ਕਿ ਨੇੜੇ ਨੇੜੇ ਹੁੰਦੇ ਹਨ ਉਸ ਘਰ ਦੇ ਨੇੜਲੇ ਘਰਾਂ ਵਿੱਚ ਜਾਂਦੇ ਹਨ ਜਿੱਥੇ ਕਿ ਉਹ ਜਾਗੋ ਨੂੰ ਲੈ ਕੇ ਜਾਂਦੇ ਨੇ ਜਿਸ ਦੇ ਵਿੱਚ ਇੱਕ ਦੀਵੇ ਰੱਖੇ ਹੁੰਦੇ ਨੇ ਉਹਨਾਂ ਦੀਵਿਆਂ ਵਿੱਚ ਤੇਲ ਪਾਇਆ ਜਾਂਦਾ ਹੈ ਇਹ ਸਾਰੇ ਜਾਣੇ ਸਾਡੇ ਸਾਰੇ ਭਾਈਚਾਰੇ ਦੇ ਵਿੱਚ ਇਹ ਸਾਰਾ ਜਿਹੜਾ ਫੰਕਸ਼ਨ ਹੈ ਜਾਂ ਜਿਹੜੀ ਪਾਰਟੀ ਹੈ ਇਸਨੂੰ ਬਹੁਤ ਜ਼ਿਆਦਾ ਇੰਜੋਏ ਕੀਤਾ ਜਾਂਦਾ ਹੈ ਬਹੁਤ ਇਹਦੇ ਵਿੱਚ ਮਸਤੀ ਕੀਤੀ ਜਾਂਦੀ ਹੈ ਅਤੇ ਸਭ ਦਾ ਪਸੰਦੀਦਾ ਜਿਹੜਾ ਹੈ ਇੱਕ ਸਮਾਗਮ ਬਣ ਜਾਂਦਾ ਹੈ